ਭੰਗੜੇ ਦੇ ਕੁਛ ਆਮ ਸਟੈਪਸ ਜਿਹਦੇ ਵਿੱਚ ਜੁਗਨੀ ਹੁੰਦੀ ਹੈ ਇੱਕ ਚਾਲ ਹੁੰਦੀ ਹੈ ਅਤੇ ਇੱਕ ਧਮਾਲ ਹੈ ਜਦੋਂ ਅਸੀਂ ਇਹ ਸਟੈਪ ਸੱਭਿਆਚਾਰ ਦੇ ਰੂਪ ਦੇ ਵਿੱਚ ਕਿਸੇ ਜਸ਼ਨ ਵਾਲੇ ਮਾਹੌਲ ਦੇ ਵਿੱਚ ਅਸੀਂ ਇਹਨੂੰ ਕਰਦੇ ਹਾਂ ਅਤੇ ਸਾਡੇ ਸਰੀਰ ਦਾ ਇੱਕ ਇੱਕ ਅੰਗ ਜਸ਼ਨ ਦੇ ਰੂਪ ਦੇ ਵਿੱਚ ਪ੍ਰਤੀਤ ਹੁੰਦਾ ਹੈ ਅਤੇ ਅਸੀਂ ਆਪਣੇ ਸੁਭਾਅ ਦੇ ਵਿੱਚ ਬਦਲਾਵ ਪੈਦਾ ਕਰਦੇ ਹਾਂ